ਸਰਦੀਆਂ ਵਿੱਚ ਤਾਂ ਚੀਕਨੇ ਭਾਂਡੇ ਜਿਹੜੇ ਮਾਂਜਣੇ ਔਖੇ ਹੁੰਦੇ ਨੇ ਪਹਿਲੇ ਗਰਮ ਪਾਣੀ ਕਰੋ ਫਿਰ ਡਿਸ਼ਵਾਸ਼ ਪਾਓ ਫਿਰ ਫਿਰ ਵਿਮ ਬਾਰ ਮਾਰੋ ਫਿਰ ਇੱਦਾਂ ਫਿਰ ਉੱਦਾਂ ਫਿਰ ਸਟੀਲ ਵੂਲ ਮਾਰੋ ਕਈ ਵਾਰੀ ਸਾਫ ਹੀ ਨਹੀਂ ਹੁੰਦੇ ਫਿਰ ਹਾਰ ਕੇ ਦੂਜਾ ਸਟੀਲ ਵੂਲ ਲੈਂਦੀ ਹਾਂ ਸਾਫ ਹੁੰਦੇ ਨੇ ਪਰ ਵਿਮ ਬਾਰ ਜਿਹੜਾ ਲੀਕੁਡ ਹੈਗਾ ਨਾ ਬਹੁਤ ਵਧੀਆ ਹੈਗਾ ਉਹਦੇ ਨਾਲ ਸਾਫ ਹੋ ਜਾਂਦੇ ਨੇ ਅਤੇ ਕਈ ਵਾਰੀ ਜੇ ਨਾ ਵੀ ਸਾਫ ਹੋਣ ਤਾਂ ਫਿਰ ਮੈਂ ਉਹ ਹੁੰਦਾ ਇੱਕ ਵੀਗੇਨਰ ਵਿਨੇਗਰ ਸਿਰਕਾ ਕਹਿੰਦੇ ਨੇ ਜਿਹਨੂੰ ਸਿਰਕੇ ਨਾਲ ਜਲਦੀ ਸਾਫ ਹੋ ਜਾਂਦੇ ਨੇ ਫਿਰ ਸਿਰਕਾ ਪਾ ਕੇ ਚਿਕਨਾਹਟ ਵਾਲੇ ਭਾਂਡੇ ਜਲਦੀ ਸਾਫ ਹੋ ਜਾਂਦੇ ਨੇ ਅਤੇ ਰਗੜ ਕੇ ਸਾਫ ਕਰਕੇ ਭਾਂਡੇ ਧੋ ਕੇ ਵਿੱਚ ਹੋ ਗਏ ਸਾਫ ਹੋ ਗਏ ਬਸ ਹੋਰ ਕਿਆ ਇਤਨਾ ਹੀ ਹੋਤਾ ਹੈ ਹੋਰ ਕਿ